ਹਾਂ ਮੇਰੇ ਸਥਾਨਕ ਬੈਂਕ ਮਿਊਚਲ ਫੰਡ ਡੈਬਿਟ ਕ੍ਰੈਡਿਟ ਕਾਰਡ 'ਤੇ ਕਰਜ਼ਾ ਦੇਣ ਦੇ ਵਿੱਚ ਸਮਰੱਥ ਹੈ ਮੇਰੇ ਸਥਾਨਕ ਬੈਂਕ ਵਿੱਚ ਲੋਕਾਂ ਦੀ ਮਾਲੀ ਹਾਲਤ ਨੂੰ ਸੁਧਾਰਨ ਲਈ ਹੋਰ ਵੀ ਬਹੁਤ ਤਰ੍ਹਾਂ ਦੀਆਂ ਸਕੀਮਾਂ ਹਨ ਜਿਨ੍ਹਾਂ ਸਕੀਮਾਂ ਦਾ ਫਾਇਦਾ ਚੱਕ ਕੇ ਲੋਕ ਆਪਣੇ ਰੁਜ਼ਗਾਰ ਅਤੇ ਬੱਚੇ ਆਪਣੀਆਂ ਫੀਸਾਂ ਦਾ ਪ੍ਰਬੰਧ ਕਰ ਰਹੇ ਹਨ ਕਿਉਂਕਿ ਇਸ ਦੀ ਵਿਆਜ ਦਰ ਬਹੁਤ ਘੱਟ ਹੈ ਮੈਂ ਆਪਣੇ ਭਾਈ ਦੀ ਪੜ੍ਹਾਈ ਲਈ ਐਜੂਕੇਸ਼ਨ ਲੋਨ ਲੈਣ ਲਈ ਅਰਜ਼ੀ ਦਿੱਤੀ ਸੀ ਜੋ ਕਿ ਬੈਂਕ ਨੇ ਸਾਡੀ ਅਰਜ਼ੀ ਬਹੁਤ ਜਲਦੀ ਮਨਜ਼ੂਰ ਕਰ ਦਿੱਤੀ ਸੀ ਅਤੇ ਸਾਨੂੰ ਲੋੜੀਂਦਾ ਪੈਸਾ ਦੇ ਕੇ ਦੇ ਦਿੱਤਾ ਸੀ ਮੇਰੇ ਸਥਾਨਕ ਬੈਂਕ ਨਾਲ਼ ਮੇਰਾ ਤਜ਼ਰਬਾ ਬਹੁਤ ਜ਼ਿਆਦਾ ਵਧੀਆ ਰਿਹਾ